ਸਾਡੇ ਨੇੜੇ ਵੈਟਰਨੀ ਡਾਕਟਰ ਹੈ ਸਾਡੇ ਏਰੀਏ ਵਿੱਚ ਹੀ ਮੇਰੇ ਪਿੰਡ ਵਿੱਚ ਹੀ ਵੈਟਰਨੀ ਹਸਪਤਾਲ ਹੈ ਅਸੀਂ ਸਮੇਂ ਸਮੇਂ 'ਤੇ ਪਸ਼ੂਆਂ ਦੀ ਚੈਕਅਪ ਕਰਾਉਂਦੇ ਹਾਂ ਸਮੇਂ ਸਮੇਂ 'ਤੇ ਟੀਕਾਕਰਨ ਹੁੰਦਾ ਹੈ ਅਜੇ ਥੋੜ੍ਹੇ ਦਿਨ ਪਹਿਲਾਂ ਹੀ ਅੱਜ ਵੀਹ ਤਰੀਕ ਹੈ ਸਤਾਰ੍ਹਾਂ ਤਰੀਕ ਨੂੰ ਡਾਕਟਰ ਮੇਰੇ ਘਰੇ ਆ ਕੇ ਪਸ਼ੂਆਂ ਦੀ ਚੈਕਅਪ ਕਰਕੇ ਗਿਆ ਜਿਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਟੀਕੇ ਕਰਨ ਕੀਤਾ ਗਿਆ ਦਵਾਈਆਂ ਦਿੱਤੀਆਂ ਗਈਆਂ ਹਰੇਕ ਪਸ਼ੂ ਦੀ ਜਾਂਚ ਕੀਤੀ ਗਈ